ਮੈਂ ਯੋਗ ਕਰਨ ਲਈ ਆਪਣੇ ਨੇੜੇ ਦੀ ਇੱਕ ਪਾਰਕ ਵਿੱਚ ਜਾਂਦੀ ਹਾਂ ਜਿੱਥੇ ਕਿ ਹਵਾ ਵੀ ਬਹੁਤ ਵਧੀਆ ਹੁੰਦੀ ਆ ਤਾਂ ਮੈਨੂੰ ਉੱਥੇ ਜਾਣਾ ਹੀ ਵਧੀਆ ਲੱਗਦਾ ਕਿ ਮੈਂ ਉੱਥੇ ਜਾ ਕੇ ਹੀ ਯੋਗ ਕਰਦੀ ਹਾਂ ਪਰ ਪਿਛਲੇ ਮਹੀਨੇ ਦੀ ਗੱਲ ਹੈ ਕਿ ਯੋਗ ਕਰਦੇ ਸਮੇਂ ਇੱਕ ਯੋਗ ਕਰ ਰਹੀ ਸੀ ਮੈਂ ਜੋ ਕਿ ਮੇਰੇ ਤੋਂ ਸਹੀ ਤਰ੍ਹਾਂ ਨਹੀਂ ਹੋਇਆ ਅਤੇ ਉਹਦੇ ਨਾਲ਼ ਹੀ ਮੇਰੇ ਬਾਂਹ 'ਚ ਮਾਸ ਫਟ ਗਿਆ ਬਾਂਹ ਦਾ ਫਿਰ ਉਹ ਉਹਦੇ ਕਰਕੇ ਮੈਨੂੰ ਯੋਗ ਕਰਨ 'ਚ ਬਾਅਦ 'ਚ ਤਕਲੀਫ ਆ ਰਹੀ ਸੀ ਤਾਂ ਮੈਨੂੰ ਡੋਕਟਰ ਕੋਲ ਲਿਜਾਣਾ ਪਿਆ ਜਿਸਦਾ ਸਾਰਾ ਇਲਾਜ ਮੈਂ ਹੋਮਿਓਪੈਥੀ ਡੋਕਟਰ ਦੇ ਸਲਾਹ ਨਾਲ਼ ਹੀ ਕੀਤਾ ਉਹਨਾਂ ਨੇ ਮੈਨੂੰ ਕੁਝ ਐਕਸਸਾਈਜ਼ਜ਼ ਦੱਸੀਆਂ ਜਿਹੜੀਆਂ ਐਕਸਸਾਈਜ਼ ਮੈਂ ਰੋਜ਼ ਕਰਦੀ ਰਹੀ ਐਕਸਸਾਈਜ਼ ਕਰਨੀ ਨਹੀਂ ਛੱਡੀ ਅਤੇ ਉਹਦੀ ਮਦਦ ਨਾਲ਼ ਹੀ ਮੈਂ ਜਲਦੀ ਆਪਣਾ ਜੋ ਬਾਂਹ ਦਾ ਮਾਸ ਫਟਿਆ ਸੀ ਉਹਨੂੰ ਵੀ ਬਿਲਕੁਲ ਸਹੀ ਕੀਤਾ ਅਤੇ ਮੈਂ ਹੁਣ ਵੀ ਮੈਂ ਯੋਗ ਕਰਦੀ ਹਾਂ ਅਤੇ ਕਿ ਕਰਦੀ ਰਹਾਂਗੀ